ਕੰਮ ਵਾਲੀ ਥਾਂ 'ਤੇ ਜੇ ਕੋਈ ਸਾਨੂੰ ਦਿੱਕਤ ਮੁਸ਼ਕਿਲ ਬਾਹਰ ਵਾਲੀ ਗੱਲ ਹੋ ਜਾਂਦੀ ਹੈ ਜਾਂ ਕੋਈ ਸਾਡੇ ਨਾਲ ਕਲਾਇੰਟ ਇਹੋ ਜਿਹਾ ਆ ਜਾਂਦਾ ਜਿਹੜਾ ਗਰਮ ਸੁਭਾਅ ਦਾ ਹੁੰਦਾ ਹੈ ਅਤੇ ਲੜਨ ਨੂੰ ਰਹਿੰਦਾ ਪਰ ਅਸੀਂ ਉਹਦੀ ਗੱਲ ਨੂੰ ਸੁਣੀਦਾ ਹੈ ਅਤੇ ਫਿਰ ਜਦੋਂ ਉਹ ਠੰਡਾ ਹੋ ਜਾਂਦਾ ਫਿਰ ਉਹਨੂੰ ਆਪਣੀ ਗੱਲ ਸਮਝਾਈ ਦੀ ਹਾਂ ਜੇ ਕਿਤੇ ਕੋਈ ਜ਼ਿਆਦਾ ਹੀ ਅੜਬ ਸੁਭਾਅ ਦਾ ਹੋਵੇ ਫਿਰ ਅਸੀਂ ਕਈ ਵਾਰ ਆਪਣੇ ਸੀਨੀਅਰ ਨਾਲ ਵੀ ਗੱਲ ਕਰਦੇ ਹਾਂ ਕਿ ਇਸ ਦਾ ਕੁਛ ਹੱਲ ਨਿਕਲ ਸਕੇ ਇਸ ਕਰਕੇ ਜ਼ਿਆਦਾਤਰ ਸਾਡੀ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਅਗਲੇ ਦਾ ਕੰਮ ਖ਼ਰਾਬ ਨਾ ਹੋਵੇ ਨਾ ਇਹ ਉਹਨੂੰ ਨੁਕਸਾਨ ਹੋਵੇ ਇਸ ਕਰਕੇ ਉਹਦੇ ਕੰਮ ਨੂੰ ਕਰੀਦਾ ਹੈ ਬਿਹਤਰ ਕਰੀਦਾ ਹੈ ਕਿ ਜਿਹੜਾ ਉਹਦਾ ਕੰਮ ਵਧੀਆ ਹੋਵੇ ਅਤੇ ਅਗਲਾ ਖੁਸ਼ੀ ਖੁਸ਼ੀ ਜਾਵੇ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ